ਹਾਂਜੀ ਮੋਹਾਲੀ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਬਾਬਾ ਹਨੂੰਮਾਨ ਸਿੰਘ ਜੀ ਦੀ ਸ਼ਹੀਦ ਦੇ ਨਾਮ ਨਾਲ ਬਣਿਆ ਹੋਇਆ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਬਹੁਤ ਬੜਾ ਬਣਿਆ ਹੋਇਆ ਉੱਥੇ ਲੋਕਾਂ ਦੀ ਬਹੁਤ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਲੋਕ ਆਪਣੀਆਂ ਸੁੱਖਨਾ ਸੁੱਖ ਕੇ ਫੇਰ ਆਪਣਾ ਅਰਦਾਸ ਕਰਵਾਉਣ ਆਉਂਦੇ ਹੈ ਅਤੇ ਗੁਰਦੁਆਰਾ ਅੰਬ ਸਾਹਿਬ ਵੀ ਸੱਤਵੇਂ ਪਾਤਸ਼ਾਹ ਹਰਿ ਰਾਇ ਜੀ ਦਾ ਬਣਾਇਆ ਯਾਦ ਵਿੱਚ ਹੈਗਾ ਉਹਨਾਂ ਦਾ ਅਸਥਾਨ ਅਤੇ ਚੱਪੜ ਚਿੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਯੁੱਧ ਹੋਇਆ ਸੀ ਫਤਿਹਗੜ੍ਹ ਸਾਹਿਬ ਦੇ ਵਜ਼ੀਰ ਖਾਂ ਦੇ ਨਾਲ ਅਤੇ ਉਸ ਵਿੱਚ ਬਾਬਾ ਬੰਦਾ ਬਹਾਦਰ ਸਿੰਘ ਜੀ ਦੀ ਜਿੱਤ ਹੋਈ ਸੀ ਅਤੇ ਉਸਦੀ ਯਾਦ ਵਿੱਚ ਫਿਰ ਫਤਿਹ ਬੁਰਜ ਬਣਾਇਆ ਗਿਆ ਅਤੇ ਸਿਸਵਾਂ ਡੈਮ ਵੀ ਬਾਹਰਲੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦਾ ਹੈ ਬਹੁਤ ਅੱਛਾ ਬਹੁਤ ਵਧੀਆ ਪਾਰਕ ਵੀ ਹੈ ਉੱਥੇ ਲੋਕ ਦੇਖਣ ਲਈ ਜਾਂਦੇ ਹੈ ਬਹੁਤ ਅੱਛਾ ਬਣਿਆ ਹੋਇਆ ਹੈ ਸਮਾਂ ਬਤੀਤ ਕਰਨ ਲਈ ਬਹੁਤ ਵਧੀਆ ਜਗ੍ਹਾ ਹੈ